ਅਠਾਰਾਂ ਨਵੰਬਰ ਦੋ ਹਜ਼ਾਰ ਤੇਈ ਛੇ ਦਸੰਬਰ ਦੋ ਹਜ਼ਾਰ ਪੰਦਰਾਂ ਗਿਆਰਾਂ ਜੁਲਾਈ ਉੱਨੀ ਸੌ ਨੱਬੇ ਵੀਹ ਅਗਸਤ ਉੱਨੀ ਸੌ ਅਠਾਸੀ ਪੰਜ ਸਤੰਬਰ ਉੱਨੀ ਸੌ ਸਤਾਸੀ